ਮੈਂ ਰਨਿੰਗ ਵਰਕਆਊਟ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਟਰੇਲ ਰਨਿੰਗ ਸਪ੍ਰਿੰਟ ਇਹਨਾਂ ਦੀ ਵੀ ਕੋਸ਼ਿਸ਼ ਕੀਤੀ ਹੈ ਅਤੇ ਦੌੜਨ ਦੇ ਸਾਨੂੰ ਬਹੁਤ ਹੀ ਫਾਇਦੇ ਹੁੰਦੇ ਹਨ ਇੱਕ ਤਾਂ ਆਪਾਂ ਤੰਦਰੁਸਤ ਰਹਿੰਦੇ ਹਨ ਦੌੜਨ ਨਾਲ਼ ਸਿਰਫ ਆਪਾਂ ਨੂੰ ਆਪਣੀ ਦੌੜਨ 'ਤੇ ਹੀ ਫੋਕੱਸ ਨਹੀਂ ਕਰਨਾ ਹੁੰਦਾ ਬਲਕਿ ਆਪਣੀ ਜੋ ਡਾਇਟ ਹੈ ਉਹਦੇ 'ਤੇ ਵੀ ਫੋਕੱਸ ਕਰਨਾ ਹੁੰਦਾ ਹੈ ਜਿਸ ਕਰਕੇ ਮੈਨੂੰ ਅੱਜ ਤੱਕ ਬਹੁਤ ਹੀ ਘੱਟ ਬਿਮਾਰੀਆਂ ਦੀ ਸ਼ਿਕਾਰ ਹੋਈ ਹਾਂ ਤਾਂ ਮੇਰੀ ਤੰਦਰੁਸਤੀ ਦੌੜਨ ਦੌੜਨ ਕਰਕੇ ਮੇਰੀ ਤੰਦਰੁਸਤੀ ਬਰਕਰਾਰ ਹੈ